ਅੱਜ ਸਾਡੇ ਘਰ ਗੈਸਟ ਆਏ ਅਤੇ ਉਹ ਮੈਨੂੰ ਕਹਿੰਦੇ ਕਿ ਤੁਸੀਂ ਨਾ ਮਤਲਬ ਮਨਚੂਰੀਅਨ ਬੜਾ ਟੇਸਟੀ ਬਣਾਉਂਦੇ ਹੋ ਤਾਂ ਅੱਜ ਤੁਸੀਂ ਸਾਨੂੰ ਮਨਚੂਰੀਅਨ ਬਣਾ ਕੇ ਖਵਾਓ ਅਤੇ ਉਹਦੇ ਲਈ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਮਸਾਲੇ ਪੈਂਦੇ ਨੇ ਪਹਿਲਾਂ ਮੈਂ ਮਾਰਕਿਟ ਗਈ ਮਾਰਕਿਟ ਜਾ ਕੇ ਕਾਲੀ ਮਿਰਚ ਦਾਲਚੀਨੀ ਜੈਫਲ ਸੁੱਕਾ ਧਨੀਆ ਜ਼ੀਰਾ ਤੇਜ ਪੱਤਾ ਮਗਾ ਮਸਾਲੇ ਸਾਰੇ ਬਾਜ਼ਾਰੋਂ ਖ਼ਰੀਦ ਕੇ ਲਿਆਂਦੇ ਫਿਰ ਮੈਂ ਉਹਨਾਂ ਨੂੰ ਘਰ ਆ ਕੇ ਥੋੜ੍ਹਾ ਰੋਸਟ ਕੀਤਾ ਤਵੇ ਦੇ ਉੱਤੇ ਰੋਸਟ ਕਰਕੇ ਫਿਰ ਉਹਨਾਂ ਨੂੰ ਮੈਂ ਮਸ਼ੀਨ ਮਸ਼ੀਨੀ ਦੇ ਵਿੱਚ ਯਾਨੀ ਕਿ ਸਾਰੇ ਯਾਨੀ ਕਿ ਮਸਾਲਾ ਬਣਾਇਆ ਮਸਾਲਾ ਬਣਾ ਕੇ ਫਿਰ ਹੁਣ ਮਨਚੂਰੀਅਨ ਬਣਾਉਣਾ ਸੀ ਉਹਦੇ ਲਈ ਮੈਂ ਗਾਜਰਾਂ ਲਿੱਤੀਆਂ ਬਾਜ਼ਾਰੋਂ ਮਟਰ ਲਿੱਤੇ ਫਲੀਆਂ ਲੀਤੀਆਂ ਬੰਦ ਗੋਭੀ ਲਿੱਤੀ ਫੁੱਲ ਗੋਭੀ ਲਿੱਤੀ ਅਰਾਰੋਟ ਲਿਆਉਂਦਾ ਮੈਦਾ ਲਿਆਉਂਦਾ ਤਾਂ ਕਿ ਵਧੀਆ ਜਿਹੀ ਮੈਂ ਅਗਲੇ ਗੈਸਟ ਨੂੰ ਡਿਸ਼ ਖਵਾ ਸਕਾਂ ਫਿਰ ਮੈਂ ਗਾਜਰਾਂ ਕੱਟੀਆਂ ਮਟਰ ਛਿੱਲੇ ਫਲੀਆਂ ਕੱਟੀਆਂ ਬੰਦ ਗੋਭੀ ਕੱਟੀ ਫੁੱਲ ਗੋਭੀ ਕੱਟੀ ਇਹਨਾਂ ਸਾਰੀਆਂ ਨੂੰ ਚੰਗੀ ਤਰ੍ਹਾਂ ਮੈਂ ਵੋਸ਼ ਕੀਤਾ ਵੋਸ਼ ਕਰਕੇ ਫਿਰ ਮੈਂ ਮੈਦਾ ਲਿੱਤਾ ਮੈਦੇ ਦੇ ਵਿੱਚ ਅਰਾਰੋਟ ਪਾ ਕੇ ਵਿੱਚ ਉਹ ਸਾਰੀਆਂ ਸਬਜ਼ੀਆਂ ਪਾਈਆਂ ਥੋੜ੍ਹੇ ਮਸਾਲੇ ਪਾਏ ਲੂਣ ਪਾਇਆ ਮਿਰਚ ਪਾਈ ਪਾ ਪੂ ਕੇ ਅਤੇ ਮੈਂ ਉਹਨਾਂ ਦੀਆਂ ਦੋ ਛੋਟੀਆਂ ਛੋਟੇ ਨਾ ਗੋਲੇ ਬਣਾ ਲਏ ਗੋਲੇ ਬਣਾ ਕੇ ਇੱਕ ਪਾਸੇ ਮੈਂ ਤੇਲ ਪਾ ਕੇ ਰੱਖ ਦਿੱਤਾ ਅਤੇ ਤੇਲ ਦੇ ਵਿੱਚ ਉਹਨਾਂ ਨੂੰ ਤਲ ਦਿੱਤਾ ਅਤੇ ਤਲ ਕੇ ਤੇ ਛੋਟੀਆਂ ਛੋਟੀਆਂ ਉਹਨਾਂ ਦੀਆਂ ਗੋਲੀਆਂ ਲੈ ਲਈਆਂ ਫਿਰ ਮੁੜ ਕੇ ਮੈਂ ਉਹਨਾਂ ਦਾ ਮਸਾਲਾ ਤਿਆਰ ਕੀਤਾ ਫਿਰ ਮੈਂ ਜਿਹੜੀਆਂ ਸਬਜ਼ੀਆਂ ਅੱਧੀਆਂ ਉਹਦੇ 'ਚ ਪਾਈਆਂ ਅੱਧੀਆਂ ਕੱਟ ਕੇ ਮੈਂ ਉਹਨਾਂ ਨੂੰ ਸਬਜ਼ੀਆਂ ਨੂੰ ਤੜਕਾ ਲਾਇਆ ਸਬਜ਼ੀਆਂ ਨੂੰ ਤੜਕਾ ਤੁੜਕਾ ਲਾ ਕੇ ਆਹਾ ਕਿਆ ਮੁਸ਼ਕ ਆ ਰਹੀ ਸੀ ਮੈਨੂੰ ਤਾਂ ਬਣਾਉਂਦੇ ਬਣਾਉਂਦੇ ਹੀ ਮੂੰਹ ਵਿੱਚੋਂ ਪਾਣੀ ਆ ਜਾਏ ਜੀਅ ਕਰੇ ਪ੍ਰਾਹੁਣਿਆਂ ਨੂੰ ਤਾਂ ਬਾਅਦ ਚ ਖਵਾਵਾਂ ਪਹਿਲਾਂ ਤਾਂ ਖਾਵਾਂ ਮੈਂ ਫਿਰ ਮੈਂ ਜਦੋਂ ਸਾਰੀ ਸਬਜ਼ੀ ਉਹ ਬਣਾ ਲਈ ਬਣਾ ਕੇ ਹੁਣ ਮੈਂ ਕਿਹਾ ਕੋਈ ਕਮੀ ਲੱਗਦੀ ਪਈ ਹੈ ਪਰ ਮੈਨੂੰ ਪਤਾ ਨਾ ਲੱਗੇ ਫਿਰ ਮੈਂ ਸੋਚਿਆ ਉਹ ਹੋ ਹਰਾ ਸੁੱਕਾ ਧਨੀਆ ਹਰਾ ਧਨੀਆ ਤਾਂ ਕੱਟ ਕੇ ਮੈਂ ਪਾਇਆ ਹੀ ਨਹੀਂ ਫਿਰ ਮੈਂ ਹਰਾ ਧਨੀਆ ਲਿੱਤਾ ਉਹਨੂੰ ਚੰਗੀ ਤਰ੍ਹਾਂ ਵੋਸ਼ ਕੀਤਾ ਉਹਨੂੰ ਬਰੀਕ ਬਰੀਕ ਕੱਟਿਆ ਅਤੇ ਉਹਨੂੰ ਡਿਲੀਸ਼ਿਸ਼ ਬਣਾਉਣ ਲਈ ਉਹਦੇ ਉੱਤੇ ਹਰਾ ਧਨੀਆ ਪਾਇਆ ਹੁਣ ਜਦ ਮੈਂ ਮਚਾ ਮਨਚੂਰੀਅਨ ਤਾਂ ਪੂਰਾ ਬਣਾ ਲਿਆ ਸੀ ਹੁਣ ਮੈਂ ਕਿਆ ਸੋਚਿਆ ਚੱਲ ਪ੍ਰਾਹੁਣੇ ਕਿਹੜਾ ਕਦੇ ਰੋਜ਼ ਰੋਜ਼ ਆ ਜਾਂਦੇ ਨੇ ਅੱਜ ਮੈਂ ਇਹਨਾਂ ਨੂੰ ਲੱਛੇਦਾਰ ਪਰੌਂਠੇ ਵੀ ਖਵਾ ਦਵਾਂ ਥੋੜ੍ਹਾ ਜਿਹਾ ਮੈਦਾ ਲਿਆ ਮੈਦਾ ਲੈ ਕੇ ਉਹਦੇ 'ਚ ਮੈਂ ਅਜਵਾਇਣ ਪਾਈ ਅਜਵਾਇਣ ਪਾ ਕੇ ਲੂਣ ਪਾਇਆ ਕਾਲੀ ਮਿਰਚ ਪਾਈ ਅਤੇ ਫਿਰ ਮੈਂ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਪਨੀਰ ਪਾ ਤਾ ਥੋੜ੍ਹੇ ਮਟਰ ਪੀਸ ਕੇ ਉਹ ਪਾ ਤੇ ਅਤੇ ਮੈਂ ਲੱਛੇਦਾਰ ਪਰੋਂਠੇ ਆਟਾ ਗੁੰਨ ਕੇ ਉਹਨਾਂ ਨੂੰ ਵੀ ਚਨਾਈ ਪਾ ਕੇ ਵੱਟ ਪਾ ਕੇ ਸੋਹਣੇ ਬੜੇ ਉਹ ਬਣਾ ਤੇ ਅਤੇ ਉੱਤੇ ਮੈਂ ਘਿਓ ਲਾਇਆ ਜਦੋਂ ਤੇ ਮੈਂ ਸੁੱਕਾ ਧਨੀਆ ਉਹਨਾਂ ਦੇ ਉੱਤੇ ਵੀ ਜਦੋਂ ਲਾਇਆ ਸੀ ਉਦੋਂ ਨਾਲ ਹੀ ਸੁੱਕਾ ਧਨੀਆ ਉਹਨਾਂ 'ਤੇ ਵੀ ਲਾ ਤਾ ਇੰਨੇ ਸਵਾਦ ਡਿਸ਼ ਬਣੀ ਕਿ ਸਾਰੇ ਹੀ ਦੇਖਦੇ ਰਹਿ ਗਏ ਲੇਕਿਨ ਇਹ ਮੈਨੂੰ ਜਿਹੜੀਆਂ ਇਹਦੀਆਂ ਸਮੱਗਰੀਆਂ ਸੀ ਨਾ ਸਾਰੀਆਂ ਇਕੱਠੀਆਂ ਕਰਨੀਆਂ ਪਈਆਂ ਪਰ ਲੇਕਿਨ ਮੇਰੇ ਘਰ ਦੇ ਜਿਹੜੇ ਆਏ ਗੈਸਟ ਇੰਨੇ ਖੁਸ਼ ਗਏ ਇੰਨੇ ਖੁਸ਼ ਗਏ ਉਹ ਮੈਨੂੰ ਕਹਿੰਦੇ ਵਾਓ ਮਨਚੂਰੀਅਨ ਇਜ ਵੈਰੀ ਬੈੱਸਟ